ਹਾਂਜੀ ਮੈਂ ਆਪਣੇ ਫੋਨ ਵਿੱਚ ਇੱਕ ਐਪ ਇੰਸਟਾਲ ਕੀਤਾ ਹੈ ਜੋ ਕਿ ਉਹਦੇ ਵਿੱਚ ਡਾਟਾ ਵੀ ਘੱਟ ਯੂਜ ਹੋਵੇ ਅਤੇ ਉਹਦੇ ਵਿੱਚ ਹਾਂ ਨੈੱਟ ਦੀ ਘੱਟ ਲੋੜ ਹੋਵੇ ਤਾਂ ਕਿ ਮੇਰਾ ਡਾਟਾ ਯੂਜ ਨਾ ਹੋਵੇ ਜਿਵੇਂ ਕਿ ਮੈਂ ਆਪਣੇ ਫੋਨ ਵਿੱਚ ਸਨੈਪਚੈਟ ਖੋਲ੍ਹੀ ਹੈ ਉਹਦੇ ਵਿੱਚ ਜਦੋਂ ਜੇਕਰ ਅਸੀਂ ਫੋਟੋਆਂ ਖਿੱਚਦੇ ਹਾਂ ਤਾਂ ਉਹਦੇ ਵਿੱਚ ਡਾਟੇ ਦੀ ਲੋੜ ਨਹੀਂ ਹੁੰਦੀ ਜੇਕਰ ਅਸੀਂ ਹਾਂ ਕੋਈ ਵੀ ਵੀਡੀਓ ਬਣਾਉਂਦੇ ਹਾਂ ਤਾਂ ਉਹਦੇ ਵਿੱਚ ਡਾਟੇ ਦੀ ਲੋੜ ਨਹੀਂ ਹੁੰਦੀ ਨਹੀਂ ਹੁੰਦੀ ਜੇਕਰ ਅਸੀਂ ਵੀਡੀਓ ਬਣਾ ਕੇ ਕੋਈ ਵੀ ਹਾਂ ਸੌਂਗ ਲਾਉਂਦੇ ਹਾਂ ਤਾਂ ਉਹਦੇ ਵਿੱਚ ਥੋੜ੍ਹੀ ਜਿਹੀ ਡਾਟੇ ਦੀ ਲੋੜ ਹੁੰਦੀ ਹੈ ਜੇਕਰ ਅਸੀਂ ਸਨੈਪਾਂ ਪਾਉਂਦੇ ਹਾਂ ਤਾਂ ਉਹਦੇ ਵਿੱਚ ਹਾਂ ਥੋੜ੍ਹੀ ਜਿਹੀ ਡਾਟੇ ਦੀ ਲੋੜ ਹੁੰਦੀ ਹੈ ਜੇਕਰ ਅਸੀਂ ਅਤੇ ਹੋਰ ਵੀ ਮੋਬਾਇਲ ਵਿੱਚ ਜੇਕਰ ਅਸੀਂ ਕੋਈ ਵੀ ਐਪ ਖੋਲ੍ਹਦੇ ਹਾਂ ਜਿਵੇਂ ਕਿ ਇੰਸਟਾ ਫੇਸਬੁੱਕ ਉਹਦੇ ਵਿੱਚ ਜ਼ਿਆਦਾ ਜ਼ਿਆਦਾ ਡਾਟੇ ਦੀ ਲੋੜ ਹੁੰਦੀ ਹੈ ਤਾਂ ਕਈ ਵਾਰ ਡਾਟਾ ਲਿਮਿਟਡ ਵੀ ਦਿਖਾ ਜਾਂਦਾ ਹੈ ਕਿਉਂਕਿ ਸਾਨੂੰ ਹਾਂ ਡਾਟੇ ਦੀ ਬ ਬਚਤ ਕਰਨੀ ਹੈ ਜਿਵੇਂ ਕਿ ਅਸੀਂ ਹਾਂ ਛੋਟੇ ਛੋਟੇ ਫੋਨਾਂ 'ਤੇ ਵੀਡੀਓ ਵੀ ਜਿਵੇਂ ਕਿ ਸਨੈਪਚੈਟ 'ਤੇ ਅਸੀਂ ਹਾਂ ਵੀਡੀਓ ਵੀ ਬਣਾ ਸਕਦੇ ਹਾਂ ਅਤੇ ਅਸੀਂ ਜੇਕਰ ਖੋਲ੍ਹਦੇ ਹਾਂ ਤਾਂ ਉਹਦੇ ਵਿੱਚ ਵੀ ਘੱਟ ਹੀ ਡਾਟਾ ਯੂਜ ਹੁੰਦਾ ਹੈ ਕਿਉਂਕਿ ਫੇਸਬੁਕ 'ਤੇ ਬਹੁਤ ਹੀ ਜ਼ਿਆਦਾ ਡਾਟਾ ਯੂਜ ਹੁੰਦਾ ਕਿਉਂਕਿ ਉਹਦੇ ਵਿੱਚ ਅਸੀ ਰੀਲਾਂ ਵੀ ਦੇਖਦੇ ਹਾਂ ਜੇ ਜੇ ਇੰਸਟਾ 'ਤੇ ਅਸੀਂ ਰੀਲਾਂ ਵੀ ਦੇਖਦੇ ਹਾਂ ਤਾਂ ਬਣਾਉਣ ਬਣਾਉਣ 'ਚ ਇੰਨਾ ਡਾਟਾ ਖਰਚ ਨਹੀਂ ਹੁੰਦਾ ਜਿੰਨਾ ਕਿ ਅਸੀਂ ਦੇਖਣ 'ਚ ਵੀਡੀਓ ਦੇਖਣ 'ਚ ਨੇਟ ਯੂਜ ਕਰਦੇ ਹਾਂ ਕਿਉਂਕਿ ਉਹਦੇ 'ਚ ਹਾਂ ਨੈਟ ਜ਼ਿਆਦਾ ਯੂਜ ਹੋ ਜਾਂਦਾ ਹੈ ਇਸ ਲਈ ਸਾਨੂੰ ਹਾਂ ਐਪ ਦੀ ਘੱਟ ਡਾਟੇ ਦੀ ਬਚਤ ਕਰਨ ਬਚਤ ਕੀਤੀ ਤਾਂ ਕਿ ਜੋ ਕਿ ਘੱਟ ਡਾਟੇ ਦੀ ਬਚਤ ਕੀਤੀ ਜਾਵੇ ਉਹ ਜਿਹਾ ਐਪ ਅਸੀਂ ਆਪਦੇ ਫੋਨ ਵਿੱਚ ਖੋਲ੍ਹਦੇ ਹਾਂ ਕਿਉਂਕਿ ਸਾਨੂੰ ਜ਼ਿਆਦਾ ਕਈ ਵਾਰ ਜ਼ਿਆਦਾ ਲਿਮਿਟਡ ਡਾਟਾ ਦਿਖਾ ਜਾਂਦੇ ਤਾਂ ਸਾਨੂੰ ਬਹੁਤ ਹੀ ਦਿੱਕਤ ਆਉਂਦੀ ਹੈ ਕਿਉਂਕਿ ਅਸੀਂ ਹੋਰ ਵੀ ਕੋਈ ਨਾ ਕੋਈ ਕੰਮ ਕਰ ਕਰਨਾ ਹੁੰਦਾ ਹੈ ਕਿਉਂਕਿ ਸਾਨੂੰ ਹਾਂ ਸਨੈਪਚੈਟ 'ਤੇ ਇੰਨਾ ਜ਼ਿਆਦਾ ਡਾਟਾ ਨਹੀਂ ਯੂਜ ਹੁੰਦਾ ਉਹਦੇ ਵਿੱਚ ਜੇ ਜੇਕਰ ਅਸੀਂ ਸਟੋਰੀ ਵੀ ਸਨੈ ਸਟੋਰੀ ਵੀ ਲਾਉਂਦੇ ਹਾਂ ਤਾਂ ਉਹਦੇ ਵਿੱਚ ਜ਼ਿਆਦਾ ਡਾਟਾ ਨਹੀਂ ਯੂਜ ਹੁੰਦਾ ਕਿਉਂਕਿ ਉਹਦੇ ਵਿੱਚ ਹਾਂ ਅਸੀਂ ਵੀਡੀਓ ਬਣਾ ਕੇ ਸੋਂਗ ਲਾ ਸਕਦੇ ਹਾਂ ਅਤੇ ਫੋਟੋਆਂ ਤੋਂ ਬਿਨਾਂ ਨੈਟ ਤੋਂ ਹੀ ਖਿੱਚ ਸਕਦੇ ਹਾਂ ਕਿਉਂਕਿ ਇੰਸਟਾ 'ਤੇ ਹਾਂ ਅਸੀਂ ਰੀਲ ਵੀ ਕਰਦੇ ਹਾਂ ਸਨੈਪ ਉਹ ਵੀ ਰੀਲਾਂ ਵੀ ਬਣਾਉਂਦੇ ਹਾਂ ਅਤੇ ਇੱਕ ਦੂਜੇ ਨੂੰ ਸੇਅਰ ਵੀ ਕਰਦੇ ਹਾਂ ਕਿਉਂਕਿ ਫੇਸਬੁਕ 'ਤੇ ਅੱਜ ਕੱਲ੍ਹ ਜ਼ਿਆਦਾ ਹੀ ਇੰਸਟਾ ਅਤੇ ਫੇਸਬੂੱਕ ਜ਼ਿਆਦਾ ਹੀ ਫੇਮਸ ਹਨ ਕਿਉਂਕਿ ਸਾਰੇ ਲੋਕ ਉਹੀ ਹੀ ਯੂਜ ਕਰਦੇ ਹਨ ਜ਼ਿਆਦਾ ਨੈੱਟ ਵਾਲਾ ਕਿਉਂਕਿ ਅੱਜ ਕੱਲ੍ਹ ਨੈਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਪੈ ਗਈ ਹੈ ਇਸ ਲਈ ਸਾਨੂੰ ਹਾਂ ਨੈੱਟ ਦੀ ਬਚਤ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਹੋਰ ਵੀ ਬਹੁਤ ਸਾਰੇ ਕੰਮ ਹਨ ਪੜ੍ਹਾਈ ਦੇ ਇਲਾਵਾ ਵੀ ਬਹੁਤ ਸਾਰੇ ਕੰਮ ਹਨ ਅਤੇ ਅੱਜ ਕੱਲ੍ਹ ਖ ਅਸੀਂ ਜਦੋਂ ਅਸੀਂ ਖਬਰਾਂ ਵੀ ਦੇਖਦੇ ਹਾਂ ਤਾਂ ਉਹਦੇ ਵਿੱਚ ਕਿਉਂਕਿ ਯੂਟੀਊਬ 'ਚ ਘੱਟ ਡਾਟਾ ਯੂਜ ਹੁੰਦਾ ਕਿਉਕਿ ਜੀ ਯੂਟੀਊਬ ਅਸੀਂ ਜ਼ਿਆਦਾ ਯੂਜ ਕਰਦੇ ਹਾਂ ਅਤੇ ਉਸ ਵਿੱਚ ਨੈੱਟ ਵੀ ਘੱਟ ਹੁੰਦਾ ਨੈਟ ਘੱਟ ਯੂਜ ਹੁੰਦਾ ਹੈ ਕਿਉਂਕਿ ਇਹਨਾਂ ਵਿੱਚ ਹਾਂ ਸਾਨੂੰ ਛੋਟੇ ਛੋਟੇ ਐਪਾਂ ਵਿੱਚ ਜ਼ਿਆਦਾ ਨੈਟ ਦੀ ਜ਼ਰੂਰਤ ਨਹੀਂ ਹੁੰਦੀ ਕ ਉਹ ਜੇਕਰ ਅਸੀਂ ਜ਼ਿਆਦਾ ਜ਼ਿਆਦਾ ਉਹ ਕਰਦੇ ਹਾਂ ਮਸੇਨਜਰ ਵਗੈਰਾ ਅਸੀਂ ਚਲਾਉਂਦੇ ਹਾਂ ਤਾਂ ਉਹਦੇ ਵਿੱਚ ਨੈੱਟ ਦੀ ਜ਼ਰੂਰਤ ਵੱਧ ਹੁੰਦੀ ਹੈ ਇਸ ਲਈ ਸਾਨੂੰ ਘੱਟ ਐਪ ਵਾਲੇ ਐਪ ਦੀ ਵਰਤੋਂ ਕਰਕੇ ਨੈਟ ਜਿਹਦੇ ਵਿੱਚ ਨੈੱਟ ਘੱਟ ਦੀ ਜ਼ਰੂਰਤ ਹੋਵੇ ਡਾਟਾ ਘੱਟ ਉਹ ਕਰਦਾ ਹੋਵੇ ਉਹਦੇ ਵਿੱਚ ਸਾਨੂੰ ਵੀਡੀਓ ਉਹੋ ਜਿਹਾ ਐਪ ਸਾਨੂੰ ਡਾਊਨਲੋਡ ਕੀਤਾ ਹੈ